ਮੇਰੇ ਵਿਚਾਰ ਅਨੁਸਾਰ ਜਿਹੜਾ ਭੰਗੜਾ ਹੈ ਭੰਗੜਾ ਐਰੋਬਿਕਸ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਸਰੀਰਕ ਤੌਰ 'ਤੇ ਚੁਣੌਤੀਪੂਰਨ ਅਤੇ ਮਜ਼ੇਦਾਰ ਇਸ ਲਈ ਬਣਾਉਂਦਾ ਹੈ ਕਿਉਂਕਿ ਜਿਹੜਾ ਨਾਚ ਗਾਣਾ ਹੁੰਦਾ ਹੈ ਉਹਦੇ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਕਈ ਤਰ੍ਹਾਂ ਲੋਕ ਐਸੇ ਵੀ ਹਨ ਜਿਹੜੇ ਕਿ ਮਾਨਸਿਕ ਤਣਾਅ ਤੋਂ ਗੁਜ਼ਰ ਰਹੇ ਹੁੰਦੇ ਹਨ ਅਤੇ ਇਹੋ ਜਿਹੇ ਹਾਲਾਤਾਂ ਵਿੱਚ ਅੱਜ ਕੱਲ੍ਹ ਈਵਨ ਅੱਜ ਕੱਲ੍ਹ ਜਿਹੜੇ ਸਾਡੇ ਜਿਹੜੇ ਵਿਗਿਆਨਿਕ ਵੀ ਹੈਗੇ ਨੇ ਜਾਂ ਸਾਡੇ ਜਿਹੜੇ ਥੈਰੇਪਿਸਟ ਹੈਗੇ ਨੇ ਉਹ ਵੀ ਇਸ ਗੱਲ ਨੂੰ ਵਿਸ਼ਵਾਸ ਨਾਲ ਕਹਿੰਦੇ ਨੇ ਕਿ ਜਿਹੜਾ ਨਾਚ ਗਾਣਾ ਹੈ ਜਿਵੇਂ ਕਿ ਭੰਗੜਾ ਐਰੋਬਿਕਸ ਹੋ ਗਈ ਜਾਂ ਗਿੱਧਾ ਹੋ ਗਿਆ ਇਸ ਤਰ੍ਹਾਂ ਦੇ ਨਾਚ ਗਾਣਿਆਂ ਨਾਲ ਜਿਹੜਾ ਕੋਈ ਵੀ ਮਨੁੱਖ ਹੈਗਾ ਹੈ ਉਸ ਨੂੰ ਮਜ਼ੇਦਾਰ ਲੱਗਦਾ ਹੈ ਉਸਨੂੰ ਆਪਣੀ ਸਰੀਰਕ ਥਕਾਨ ਦੂਰ ਹੋ ਜਾਂਦੀ ਹੈ ਅਤੇ ਅਸ ਉਸਦਾ ਜਿਹੜਾ ਸੰ ਸੰਤੁਲਨ ਹੈ ਉਹ ਵੀ ਬਣਿਆ ਰਹਿੰਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਲ ਟਰੰਪ ਨੇ ਗੱਦੀ 'ਤੇ ਬੈਠਦਿਆਂ ਹੀ ਜਿਨ੍ਹਾਂ ਕਾਰਜਕਾਰੀ ਆਦੇਸ਼ਾਂ 'ਤੇ ਹਸਤਾਖਰ ਕੀਤੇ ਸਨ ਉਹਨਾਂ ਵਿੱਚ ਮੈਕਸੀਕੋ ਨਾਲ ਲੱਗਦੀ ਦੱਖਣੀ ਅਮਰੀਕੀ ਸਰਹੱਦ 'ਤੇ ਐਮਰਜੈਂਸੀ ਦੇ ਘੋਸ਼ਣਾ ਅਮਰੀਕਾ ਵਿੱਚ ਸ਼ਰਨ ਮੰਗਣ ਵਾਲਿਆਂ ਨੂੰ ਮੈਕਸੀਕੋ ਵਾਪਿਸ ਭੇਜਣਾ ਅਤੇ ਸਭ ਤੋਂ ਵੱਡੀ ਗੱਲ ਸੀ ਮੈਕਸੀਕੋ ਦੇ ਨਸ਼ੇ ਅਤੇ ਮਨੁੱਖੀ ਤਸਕਰ ਗਰੋਹ ਜਿਸ ਨੂੰ ਸਪੈਨਿਸ਼ ਕੋਟਲ ਕਿਹਾ ਜਾਂਦਾ ਹੈ ਇਹਨੂੰ ਅੱਤਵਾਦੀ ਸੰਗਠਨ ਐਲਾਨਣਾ ਇਹ ਉਹ ਹੀ ਗਰੋਹ ਹੈ ਜਿਸ ਨੇ ਅਮਰੀਕਾ ਨੂੰ ਫੈਂਟਨਲ ਵਰਗੇ ਅਨੇਕਾਂ ਘਾਤਕ ਨਸ਼ਿਆਂ ਅਤੇ ਜ਼ਾਲਮ ਅਪਰਾਧੀ ਗਰੋਹਾਂ ਨਾਲ ਭਰ ਦਿੱਤਾ ਹੈ ਟਰੰਪ ਨੇ ਆਪਣੀ ਚੋਣ ਮੁਹਿੰਮ ਵਿੱਚ ਇਹਨਾਂ ਗਰੋਹਾਂ ਨੂੰ ਦੇਸ਼ ਨਿਕਾਲਾ ਅਤੇ ਕਾਟਿਲ ਦਾ ਮੁਕਾਬਲਾ ਕਰਨ ਲਈ ਮੈਕਸੀਕੋ 'ਚ ਫੌਜ ਦਾਖਲ ਕਰਨ ਦੀ ਵੀ ਧਮਕੀ ਦਿੱਤੀ ਸੀ ਜਿਸ ਦਾ ਰਾਸ਼ਟਰਪਤੀ ਕਲਾਊਡ ਸ਼ੀਨਬੋਮ ਨੇ ਵਿਰੋਧ ਕੀਤਾ ਸੀ ਜਿਸ ਤਰ੍ਹਾਂ ਹੁਣ ਤੱਕ ਇਹਨਾਂ ਕਾਟਿਲ ਨੇ ਪਰਵਾਸੀ ਤਸਕਰੀ ਨਾਲ ਵੱਡਾ ਮੁਨਾਫੇ ਵਾਲਾ ਤੰਤਰ ਖੜਾ ਕੀਤਾ ਹੈ ਡਰੱਗ ਤਸਕਰੀ ਦੇ ਮਜ਼ਬੂਤ ਪਕੜ ਬਣਾਈ ਹੈ ਉਨਾਂ ਨੂੰ ਹੁਣ ਸ਼ੀਨਬੋਮ ਨੇ ਅੱਤਵਾਦੀ ਸੰਗਠਨ ਐਲਾਨਣ ਦੀ ਅਮਰੀਕਾ ਨੂੰ ਖੁੱਲ੍ਹ ਦੇ ਦਿੱਤੀ ਹੈ ਅਤੇ ਇਹਨਾਂ ਕਾਟਿਲਾਂ ਵਿਰੁੱਧ ਲੜਨ 'ਤੇ ਮੈਕਸੀਕੋ ਦੇ ਦੋ ਗੁਆਂਢੀ ਮੁਲਕਾਂ ਨਾਲ ਤਾਲਮੇਲ ਪੈਦਾ ਕੀਤਾ ਹੈ ਇਹ ਹੋਰ ਦਿਲਚਸਪ ਗੱਲ ਇੱਥੇ ਇਹ ਹੈ ਕਿ ਮਨੁੱਖੀ ਤਸਕਰੀ ਦਾ ਕੰਮ ਇਹ ਗਰੋਹ ਕਰਦਾ ਹੈ ਜਿਸ ਨੂੰ ਕਿਊਤੇ ਕਿਹਾ ਜਾਂਦਾ ਹੈ ਕਿਊਤਾ ਇੱਕ ਕੁੱਤੇ ਵਰਗਾ ਜਾਨਵਰ ਹੈ ਜੋ ਦਿਨ ਨੂੰ ਸੁਸਤ ਅਤੇ ਸੁੱਤਾ ਰਹਿੰਦਾ ਹੈ ਪਰ ਰਾਤ ਵੇਲੇ ਪੂਰਾ ਫੁਰਤੀਲਾ ਹੁੰਦਾ ਹੈ ਅਤੇ ਫਸਿਆ ਵੀ ਨਹੀਂ ਜਾ ਅਤੇ ਫੜਿਆ ਵੀ ਨਹੀਂ ਜਾ ਸਕਦਾ ਉਹ ਜਾਨਵਰ

ਹਾਂ ਇਹਨਾਂ ਨੂੰ ਅੱਤਵਾਦੀ ਸੰਗਠਨ ਕਹਿ ਕੇ ਅੱਤਵਾਦੀ ਵਿਰੁੱਧ ਕਾਨੂੰਨਾਂ ਤਹਿਤ ਹੱਥ ਲੰਬੇ ਕਰਕੇ ਮੋਟੀ ਨੱਥ ਜ਼ਰੂਰ ਪਾ ਸਕਦੇ ਹਾਂ ਕੌਣ ਹਨ ਇਹ ਕਾਟਿਲ ਇਹ ਉਹ ਮੈਕਸੀਕਨ ਤਾਕਤਵਰ ਮਾਫ਼ੀਆ ਹੈ ਜੋ ਅਮਰੀਕਾ ਨੂੰ ਕੋਕੀਨ ਹੈਰੋਇਨ ਫੈਂਟਲਿਨ ਜਾਂ ਹੋਰ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਸਪਲਾਈ ਕਰਦਾ ਹੈ ਮਨੁੱਖੀ ਤਸਕਰੀ ਦੇ ਇਸ ਸਮ ਸਾਮਰਾਜ ਜਿਸ ਨੂੰ ਅਮਰੀਕਾ ਬਹੁਤ ਖਫ਼ਾ ਹੈ ਨੂੰ ਟਰੰਪ ਪ੍ਰਸ਼ਾਸਨ ਪੂਰੀ ਗੰਭੀਰਤਾ ਨਾਲ ਲੈ ਰਿਹਾ ਹੈ